ਮੋਹਾਲੀ ਜ਼ਿਲ੍ਹੇ ਦੇ ਵਿੱਚ ਆਵਾਜਾਈ ਦੇ ਸਾਧਨ ਜਿਵੇਂ ਕਿ ਬੱਸ ਆਟੋ ਰਿਸ਼ਕਾ ਔਰ ਉਸ ਤੋਂ ਬਾਅਦ ਓਲਾ ਕੋਬਰ ਉਵੇਰ ਓਲਾ ਕੈਬ ਇਨਡਰਾਈਵ ਬਾਈਕ ਰਾਈਡ ਇੱਦਾਂ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਵਾਜਾਈ ਦੇ ਸਾਧਨ ਹਨ ਓਥੋਂ ਸਭ ਤੋਂ ਵਧੀਆ ਬੱਸ ਸਟੈਂਡ ਬਣੇ ਹੋਏ ਹਨ ਜਿਸ ਕਰਕੇ ਪੌਪਲੇਸ਼ਨ ਜ਼ਿਆਦਾ ਹੋਣ ਕਰਕੇ ਹਰੇਕ ਚੀਜ਼ ਦੀ ਉੱਥੇ ਸਹੂਲਤਾਂ ਪਾਈ ਗਈ ਹੈ ਮੋਹਾਲੀ ਦੇ ਵਿੱਚ ਔਰ ਬੜਾ ਸਾਫ਼ ਸੁਥਰਾ ਅਤੇ ਅੱਛਾ ਸ਼ਹਿਰ ਹੈ ਔਰ ਉੱਥੇ ਇੰਟਰਨੈਸ਼ਨਲ ਏਅਰਪੋਰਟ ਵੀ ਹੈ ਮੋਹਾਲੀ ਹੋਰ ਬਹੁਤ ਤਰ੍ਹਾਂ ਦੀਆਂ ਸਹੂਲਤਾਂ ਹਨ ਜਿਵੇਂ ਕਿ ਹੋਸਪੀਟਲ ਸਰਕਾਰੀ ਹੋਸਪੀਟਲ ਪ੍ਰਾਈਵੇਟ ਹੋਸਪੀਟਲ ਨਾਲ਼ੇ ਚੰਡੀਗੜ੍ਹ ਵੀ ਲੱਗਦਾ ਉਹ ਵੀ ਸੇਮ ਟੂ ਸੇਮ ਮੋਹਾਲੀ ਔਰ ਚੰਡੀਗੜ੍ਹ ਸੇਮ ਏ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਹਨ ਇਸ ਕਰਕੇ ਮੋਹਾਲੀ ਸ਼ਹਿਰ ਬਹੁਤ ਵਧੀਆ